ਮੈਂ ਬਚਿੰਤ ਕੌਰ ਦੀ ਸਵੈ ਜੀਵਨੀ ਪਗਡੰਡੀਆਂ ਪੜ੍ਹੀ ਉਸਦੇ ਵਿੱਚ ਉਹਨਾਂ ਦਾ ਜਿਹੜਾ ਵਿਆਹ ਬਹੁਤ ਛੋਟੀ ਉਮਰ ਦੇ ਵਿੱਚ ਕਰ ਦਿੱਤਾ ਜਾਂਦਾ ਗਾ ਸਾਰਾ ਪੰਦਰਾਂ ਸੌਲਾਂ ਸਾਲ ਦੀ ਉਮਰ ਦੇ ਵਿੱਚ ਜਦੋਂ ਕਿ ਉਹ ਪੜ੍ਹਨਾ ਚਾਹੁੰਦੇ ਸੀਗੇ ਅਤੇ ਵਿਆਹ ਤੋਂ ਬਾਅਦ ਵੀ ਜਿਹੜਾ ਉਹਨਾਂ ਦਾ ਜੀਵਨ ਸਾਥੀ ਹੁੰਦਾ ਸਾਧੂ ਸਿੰਘ ਉਹ ਸ਼ਰਾਬੀ ਕਿਸਮ ਦਾ ਆਦਮੀ ਹੁੰਦਾ ਗਾ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਵੀ ਆ ਅਤੇ ਇੱਕ ਟਾਈਮ ਉਹ ਪਹਿਲੀ ਦਿੱਲੀ ਦੀ ਲੇਡੀ ਹੋਏ ਨੇ ਜਿਹਨਾਂ ਨੇ ਸੇਲਜ਼ਮੈਨ ਦੇ ਤੌਰ 'ਤੇ ਕੰਮ ਕੀਤਾ ਉਹਨਾਂ ਨੇ ਅਤੇ ਇੱਕ ਵਾਰ ਉਹਨਾਂ ਨੂੰ ਲੇਟ ਆਉਣ ਕਰਕੇ ਜਦੋਂਂ ਜੋਬ ਤੋਂ ਕੱਢ ਦਿੱਤਾ ਜਾਂਦਾ ਗਾ ਅਤੇ ਇਹ ਉਹਦੇ ਵਿੱਚ ਬਹੁਤ ਇਸ ਚੀਜ਼ ਨੇ ਮੈਨੂੰ ਬਹੁਤ ਭਾਵੁਕ ਕੀਤਾ ਸੀ ਅਤੇ ਇੱਕ ਵਾਰ ਉਹਨਾਂ ਦੇ ਘਰ ਵਾਲਾ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਆਉਂਦਾ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਗਾ ਈਵਨ ਕਿ ਉਹ ਕੰਮ ਕਰਦੇ ਨੇ ਉਹਨਾਂ ਦਾ ਘਰ ਵਾਲਾ ਕੋਈ ਵੀ ਕੰਮ ਵੀ ਨਹੀਂ ਕਰਦਾ ਅਤੇ ਹਮ ਕਿੰਨੇ ਕਿੰਨੇ ਦਿਨ ਘਰ ਤੋਂ ਬਾਹਰ ਰਹਿੰਦਾ ਅਤੇ ਕਾਫੀ ਦਿਨਾਂ ਤੋਂ ਬਾਅਦ ਉਹ ਜਦੋਂ ਘਰ ਆਉਂਦਾ ਅਤੇ ਉਹਨਾਂ ਨੂੰ ਆ ਕੇ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਉਹਨਾਂ ਨੂੰ ਜ਼ਖਮੀ ਕਰ ਦਿੰਦਾ ਇਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਭਾਵੁਕ ਕੀਤਾ ਅਤੇ ਇਹ ਚੀਜ਼ ਮੇਰੇ ਲਈ ਬਹੁਤ ਜ਼ਿਆਦਾ ਭਾਵੁਕ ਸੀਗੀ ਉਸ ਟਾਈਮ 'ਤੇ ਅਤੇ ਹੋਰ ਵੀ ਬਹੁਤ ਜ਼ਿਆਦਾ ਉਹ ਆਪਣੀ ਜਿਹੜੀ ਸਵੈਜੀਵਨੀ ਦੇ ਵਿੱਚ ਦੱਸਦੇ ਨੇ ਬਹੁਤ ਜ਼ਿਆਦਾ ਉਹਨਾਂ ਨੇ ਸੰਘਰਸ਼ ਕੀਤੇ ਨੇ ਅਤੇ ਉਹ ਜੋਬ ਦੇ ਨਾਲ ਨਾਲ ਪੜ੍ਹਦੇ ਵੀ ਸੀ ਬੱਚਿਆਂ ਨੂੰ ਵੀ ਪਾਲਦੇ ਸੀ ਅਤੇ ਹੁਣ ਉਹ ਦਿੱਲੀ ਦੀਆਂ ਝੁੱਗੀ ਝੋਂਪੜੀਆਂ ਦੇ ਵਿੱਚ ਰਹੇ ਜਿੱਥੇ ਨਾ ਕੋਈ ਪਾਣੀ ਦੀ ਸਹੂਲਤ ਸੀ ਨਾ ਬਿਜਲੀ ਦੀ ਸਹੂਲਤ ਸੀ ਪਰ ਫਿਰ ਵੀ ਉਹ ਸਾਰਾ ਕੁਛ ਮੈਨੇਜ ਕਰਦੇ ਨੇ ਆਪਣੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਮਿਹਨਤ ਕਰਦੇ ਨੇਗੇ ਅਤੇ ਇਹ ਚੀਜ਼ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਵਧੀਆ ਲੱਗੀ ਕਿ ਉਹ ਕਦੇ ਵੀ ਹਾਰੇ ਨਹੀਂ ਹੈਗੇ ਅਤੇ ਪੂਰੀ ਹਿੰਮਤ ਦੇ ਨਾਲ ਉਹਨਾਂ ਨੇ ਪੜ੍ਹਾਈ ਵੀ ਕੀਤੀ ਤੇ ਨਾਲ ਨਾਲ ਇੱਕ ਜੋਬ ਵੀ ਕੀਤੀ ਪੜ੍ਹੇ ਵੀ ਇਸ ਤੋਂ ਬਾਅਦ ਉਹਨਾਂ ਨੇ ਐੱਮਫਿਲ ਪੀਐੱਚਡੀ ਦੀ ਡਿਗਰੀ ਵੀ ਕੀਤੀ